ਅਸੀਂ ਪੰਜਾਬ ਪ੍ਰਾਂਤ ਵਿੱਚ ਰਹਿੰਦੇ ਹਾਂ ਅਤੇ ਇੱਥੇ ਵੱਖਰੇ ਵੱਖਰੇ ਸ਼ਹਿਰ ਹਨ ਅਸੀਂ ਪੰਜਾਬ ਪ੍ਰਾਂਤ ਦੇ ਤਰਨ ਤਾਰਨ ਜ਼ਿਲ੍ਹੇ ਵਿੱਚ ਰਹਿੰਦੇ ਹਾਂ ਇਹ ਇੱਕ ਇਤਿਹਾਸਿਕ ਸ਼ਹਿਰ ਹੈ ਜੋ ਕਿ ਸਿੱਖਾਂ ਦੇ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਵਸਾਇਆ ਹੈ ਸਭ ਤੋਂ ਪਹਿਲਾਂ ਸ਼ਹਿਰ ਦੀ ਮਹੱਤਤਾ ਇੱਥੇ ਸ਼੍ਰੀ ਦਰਬਾਰ ਸਾਹਿਬ ਕਰਕੇ ਹੈ ਜਿਸ ਵਿੱਚ ਇੱਕ ਸਰੋਵਰ ਹੈ ਜੋ ਕਿ ਸਭ ਤੋਂ ਵੱਡਾ ਮੰਨਿਆ ਜਾਂਦਾ ਹੈ ਇੱਥੇ ਦੇ ਲੋਕ ਮਾਝੇ ਇਲਾਕੇ ਨਾਲ ਸੰਬੰਧਿਤ ਹਨ ਅਤੇ ਉਹ ਠੇਠ ਪੰਜਾਬੀ ਬੋਲਦੇ ਹਨ ਇੱਥੇ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ ਹਿੰਦੂ ਸਿੱਖ ਈਸਾਈ ਮੁਸਲਮਾਨ ਇੱਥੇ ਹਰ ਧਰਮ ਨਾਲ ਸੰਬੰਧਿਤ ਧਾਰਮਿਕ ਸਥਾਨ ਹਨ ਜਿਵੇਂ ਹਿੰਦੂਆਂ ਦੇ ਮੰਦਰ ਵੀ ਹਨ ਇੱਕ ਵੱਡਾ ਮੰਦਰ ਹੈ ਛੋਟਾ ਮੰਦਰ ਹੈ ਅਤੇ ਇੱਕ ਸ਼ਿਵਜੀ ਜੀ ਦਾ ਮੰਦਰ ਹੈ ਈਸਾਈ ਲੋਕਾਂ ਦਾ ਇੱਥੇ ਇੱਕ ਚਰਚ ਵੀ ਹੈ ਮੁਸਲਮਾਨਾਂ ਦੀ ਦਰਗਾਹ ਵੀ ਹੈ ਇੱਕ ਜੰਦੂ ਪੀਰ ਦਰਗਾਹ ਹੈ ਜਿੱਥੇ ਸਲਾਨਾ ਮੇਲਾ ਲੱਗਦਾ ਹੈ ਇੱਥੋਂ ਦੇ ਲੋਕਾਂ ਦਾ ਪਹਿਰਾਵਾ ਸਾਦਾ ਹੈ ਆਸ ਪਾਸ ਕਾਫੀ ਪਿੰਡ ਹਨ ਅਤੇ ਇਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਲੱਗਦਾ ਹੈ ਸਭ ਤੋਂ ਵੱਡੀ ਵਿਸ਼ੇਸ਼ਤਾ ਇਸ ਦੀ ਇਹ ਹੈ ਕਿ ਇੱਥੇ ਗੁਰਦੁਆਰਾ ਸਾਹਿਬ ਜੋ ਗੁਰੂ ਅਰਜਨ ਦੇਵ ਜੀ ਨੇ ਆਪ ਤਿਆਰ ਕਰਵਾਇਆ ਕਿਹਾ ਜਾਂਦਾ ਹੈ ਕਿ ਮੱਸਾ ਸਿੰਘ ਨਾਮ ਦੇ ਇੱਕ ਵਿਅਕਤੀ ਕੋਲੋਂ ਗੁਰੂ ਜੀ ਨੇ ਜ਼ਮੀਨ ਖਰੀਦ ਕੇ ਇਹ ਬਣਵਾਇਆ ਸੀ ਅਤੇ ਗੁਰੂ ਜੀ ਨੇ ਉਸ ਨੂੰ ਵਰ ਦਿੱਤਾ ਸੀ ਕਿ ਮੱਸਿਆ ਵਾਲੇ ਦਿਨ ਇੱਥੇ ਤੇਰੇ ਨਾਮ ਦੀ ਮੱਸਿਆ ਲੱਗੇਗੀ ਸੋ ਇੱਥੇ ਹਰ ਦਿਹਾੜੇ ਵੀ ਮਨਾਏ ਜਾਂਦੇ ਹਨ ਪਰ ਮੱਸਿਆ ਵਾਲੇ ਦਿਨ ਬਹੁਤ ਦੂਰ ਦੂਰ ਤੋਂ ਸੰਗਤ ਦਰਸ਼ਨਾਂ ਲਈ ਇੱਥੇ ਆਉਂਦੀ ਹੈ ਅਤੇ ਇੱਥੇ ਇਸ਼ਨਾਨ ਕਰਨ ਨਾਲ ਕਈ ਤਰ੍ਹਾਂ ਦੇ ਦੁੱਖ ਦੂਰ ਹੁੰਦੇ ਹਨ ਬਾਕੀ ਸੰਗਰਾਂਦ ਪੂਰਨਮਾਸੀ ਜਾਂ ਦਸਾਂ ਗੁਰੂ ਸਾਹਿਬਾਨਾਂ ਦੇ ਗੁਰਪੁਰਬ ਵੀ ਮਨਾਏ ਜਾਂਦੇ ਹਨ